ਮੈਂ ਅੰਮ੍ਰਿਤਸਰ ਵਿੱਚ ਰਹਿੰਦਾ ਅਤੇ ਮੇਰੇ ਘਰ ਦੇ ਨੇੜੇ ਕਾਫੀ ਧਾਰਮਿਕ ਸਥਾਨ ਹਨ ਜਿਵੇਂ ਰਾਮ ਤੀਰਥ ਦੁਰਗਿਆਣਾ ਮੰਦਰ ਦਰਬਾਰ ਸਾਹਿਬ ਅਤੇ ਇਸ ਤੋਂ ਇਲਾਵਾ ਕਾਫੀ ਸਮਾਰਕ ਵੀ ਹਨ ਜਿਵੇਂ ਜਲ੍ਹਿਆਂਵਾਲਾ ਬਾਗ ਅਤੇ ਵਾਰ ਮਮੋਰੀਅਲ ਇਹਨਾਂ ਥਾਵਾਂ 'ਤੇ ਕਾਫੀ ਲੋਕ ਆਉਂਦੇ ਰਹਿੰਦੇ ਹਨ ਹਰ ਮੌਸਮ ਵੈਸੇ ਤਾਂ ਹਰ ਮੌਸਮ ਵਿੱਚ ਇੱਥੇ ਭੀੜ ਲੱਗੀ ਰਹਿੰਦੀ ਹੈ ਲੇਕਿਨ ਜੇ ਮੈਂ ਗੱਲ ਕਰਾਂ ਤਾਂ ਗਰਮੀ ਅਤੇ ਸਰਦੀਆਂ ਦੀਆਂ ਛੁੱਟੀਆਂ ਵਿੱਚ ਇੱਥੇ ਕਾਫੀ ਰੌਣਕ ਲੱਗੀ ਰਹਿੰਦੀ ਹੈ ਕਿਉਂਕਿ ਬੱਚਿਆਂ ਨੂੰ ਉਸ ਟਾਈਮ ਛੁੱਟੀ ਹੋਣ ਕਰਕੇ ਕਾਫੀ ਲੋਕ ਇੱਥੇ ਘੁੰਮਣ ਲਈ ਆਉਂਦੇ ਹਨ ਦਰਬਾਰ ਸਾਹਿਬ ਵਿੱਚ ਗੁਰਪੁਰਬ ਅਤੇ ਨਵੇਂ ਸਾਲ ਦੇ ਮੌਕੇ ਉੱਤੇ ਕਾਫੀ ਭੀੜ ਲੱਗੀ ਰਹਿੰਦੀ ਹੈ ਰਾਮ ਤੀਰਥ ਵਿੱਚ ਅ ਮੇਲਾ ਲੱਗਦਾ ਹੈ ਜਿਸ ਕਰਕੇ ਉੱਥੇ ਕਾਫੀ ਲੋਕ ਆਉਂਦੇ ਰਹਿੰਦੇ ਹਨ ਅਤੇ ਉਸ ਮੇਲੇ ਵਿੱਚ ਕਾਫੀ ਸੈਲਾਨੀ ਆਉਂਦੇ ਹਨ ਆਪਣੇ ਬੱਚਿਆਂ ਨਾਲ ਆਪਣੇ ਰਿਸ਼ਤੇਦਾਰਾਂ ਨਾਲ ਘੁੰਮਣ ਆਉਂਦੇ ਹਨ ਇਸ ਤੋਂ ਇਲਾਵਾ ਜੋ ਸਮਾਰਕ ਹਨ ਜੇ ਮੈਂ ਉਹਨਾਂ ਦੀ ਗੱਲ ਕਰਾਂ ਤਾਂ ਵਾਰ ਮਮੋਰੀਅਲ ਵਿੱਚ ਜਦੋਂ ਕੋਈ ਵਾਹਗਾ ਬੌਡਰ ਆਉਂਦਾ ਹੈ ਅਤੇ ਉਹ ਵਾਰ ਮਮੋਰੀਅਲ ਵੀ ਜ਼ਰੂਰ ਜਾਂਦਾ ਹੈ ਉਸ ਤੋਂ ਜਲ ਜਲ੍ਹਿਆਂਵਾਲਾ ਬਾਗ ਜੋ ਸਾਡੇ ਦਰਬਾਰ ਸਾਹਿਬ ਦੇ ਨੇੜੇ ਹੈ ਉੱਥੇ ਲੋਕ ਆਉਂਦੇ ਹਨ ਅਤੇ ਆਪਣੇ ਇਤਿਹਾਸ ਨੂੰ ਜਾਣਦੇ ਹਨ ਕਿ ਜਿਲ੍ਹਿਆਂਵਾਲਾ ਬਾਗ ਕਾਂਡ ਕੀ ਹੋਇਆ ਸੀ ਉੱਥੇ ਆਪਣੇ ਇਤਿਹਾਸ ਨੂੰ ਜਾਣ ਕੇ ਉਹਨਾਂ ਨੂੰ ਸਭ ਪਤਾ ਲੱਗਦਾ ਹੈ ਕਿ ਅੰਗਰੇਜ਼ਾਂ ਨੇ ਭਾਰਤ ਦੇ ਉੱਤੇ ਕੀ ਜ਼ੁਲਮ ਕੀਤਾ ਅਤੇ ਉਹਨਾਂ ਨੂੰ ਸਿੱਖਿਆ ਮਿਲਦੀ ਹੈ ਇਸ ਇਸ ਤਰ੍ਹਾਂ ਸਾਡੇ ਅੰਮ੍ਰਿਤਸਰ ਸ਼ਹਿਰ ਵਿੱਚ ਕਾਫੀ ਧਾਰਮਿਕ ਸਥਾਨ ਹਨ ਅਤੇ ਉਪ ਸਮਾਰਕ ਹਨ ਜਿਨ੍ਹਾਂ 'ਤੇ ਭੀੜ ਲੱਗੀ ਰਹਿੰਦੀ ਹੈ